ਹਾਂ ਮੈਨੂੰ ਭੌਤਿਕ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਕਿਉਂਕਿ ਇਹ ਕਿਤਾਬਾਂ ਆਪਣੇ ਮਨ ਨੂੰ ਸ਼ਾਂਤੀ ਅਤੇ ਬਹੁਤ ਜ਼ਿਆਦਾ ਸਕੂਨ ਦਿੰਦਾ ਹੈ ਇਲੈਕਟਰੋਨਿਕ ਸੰਸਕਰਨ ਵੀ ਅੱਜ ਆਪਣੇ ਕੋਲ ਬਹੁਤ ਜ਼ਿਆਦਾ ਅਵੇਲੇਬਲ ਹੈ ਇਸ ਲਈ ਇਲੈਕਟਰੋਨਿਕ ਜੋ ਸੰਸਕਰਣ ਹੈ ਉਹਨਾਂ ਰਾਹੀਂ ਵੀ ਆਪਾਂ ਬਹੁਤ ਕੁਛ ਪੜ੍ਹ ਸਕਦੇ ਹਾਂ ਸੁਣ ਸਕਦੇ ਹਾਂ ਕਿਉਂਕਿ ਉਹਨਾਂ ਵਿੱਚ ਵੀ ਸਭ ਉਹ ਹੀ ਸਭ ਦਿੱਤਾ ਹੁੰਦਾ ਹੈ ਜੋ ਭੌਤਿਕ ਕਿਤਾਬਾਂ ਵਿੱਚ ਦਿੱਤਾ ਹੁੰਦਾ ਹੈ ਜੇਕਰ ਆਪਾਂ ਗੱਲ ਕਰਦੇ ਹਾਂ ਭੌਤਿਕ ਕਿਤਾਬਾਂ ਦੀ ਤਾਂ ਭੌਤਿਕ ਕਿਤਾਬਾਂ ਪੜ੍ਹਦਿਆਂ ਪੜ੍ਹਦਿਆਂ ਪਤਾ ਹੀ ਨਹੀਂ ਲੱਗਦਾ ਕਿ ਬੰਦਾ ਕਿੰਨਾ ਕੁ ਪੜ੍ਹ ਲੈਂਦਾ ਅਤੇ ਜੇਕਰ ਗੱਲ ਕਰਦੇ ਹਾਂ ਭਾਈ ਇਲੈਕਟਰੋਨਿਕ ਸੰਸਕਰਨਾਂ ਰਾਹੀਂ ਪੜ੍ਹਨ ਦੀ ਤਾਂ ਓ ਉਹਨਾਂ ਰਾਹੀਂ ਆਪਾਂ ਥੋੜ੍ਹੇ ਟਾਈਮ ਲਈ ਹੀ ਕੁਛ ਸੁਣ ਸਕਦੇ ਹਾਂ ਜਾਂ ਪੜ੍ਹ ਸਕਦੇ ਹਾਂ ਹਾਂ ਮੈਂ ਬਹੁਤ ਜ਼ਿਆਦਾ ਓਡੀਓ ਬੁੱਕ ਸੁਣੀਆਂ ਹਨ ਜਿਨ੍ਹਾਂ ਵਿੱਚ ਜਿਨ੍ਹਾਂ ਵਿੱਚੋਂ ਕਿ ਜਿਵੇਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਹੈ ਲੂਣਾ ਲੂਣਾ ਵੀ ਬਹੁਤ ਵਧੀਆ ਉਹਨਾਂ ਦੀ ਰਚਨਾ ਹੈ ਅਤੇ ਜਿਵੇਂ ਹੋਰ ਮੈਂ ਇੱਕ ਬੁੱਕ ਪੜ੍ਹੀ ਸੀ ਇਹਨਾਂ ਦੀ ਡਾਕਟਰ ਬੀਨਾ ਦੀ ਇਹਨਾਂ ਨੇ ਲਿਖੀ ਸੀ ਮੁੱਲ ਦੀ ਤੀਵੀਂ ਉਹ ਵੀ ਬਹੁਤ ਵਧੀਆ ਬੁੱਕ ਆ ਨਾਰੀ ਸ਼ ਨਾਰੀ ਸ਼ਕਤੀ ਲਾ ਕਹਿ ਲਓ ਤੁਸੀਂ ਚਾਹੇ ਤਾਂ ਨਾਰੀ ਦੇ ਉੱਤੇ ਉਹਨਾਂ ਨੇ ਬਹੁਤ ਕੁਝ ਉਹਦੇ ਵਿੱਚ ਲਿਖਿਆ ਹੋਇਆ ਹੈ ਔਰ ਜੇ ਗੱਲ ਕਰਦੇ ਹਾਂ ਆਪਾਂ ਹੋਰ ਮੇਰੀ ਇਕਲੈਕਟ ਇਲੈਕਟਰੋਨਿਕ ਸੰਸਕਰਨ ਦੀ ਜੋ ਮੈਂ ਬੁੱਕ ਪੜ੍ਹੀ ਸੀ ਮੇਰਾ ਦਾਗਿਸਤਾਨ ਰਸੂਲ ਹਮਜਦ ਹਮਜਦਹੁਰ ਦੀ ਤਾਂ ਉਹ ਵੀ ਬਹੁਤ ਵਧੀਆ ਲੱਗੀ ਮੈਨੂੰ ਉਹਨਾਂ ਦੀ ਬੁੱਕ ਹੋਰ ਵੀ ਬਹੁਤ ਸਾਰੀਆਂ ਜਿਵੇਂ ਮੜੀ ਦਾ ਦੀਵਾ ਮੈਂ ਪੜ੍ਹੀ ਹੋਈ ਆ ਉਹ ਵੀ ਬਹੁਤ ਵਧੀਆ ਕਿਤਾਬ ਹੈ ਧੰਨਵਾਦ